ਖੇਡਾਂ ਖੇਡਣ ਦਾ ਮੈਨੂੰ ਬਹੁਤ ਸ਼ੌਕ ਹੈ ਖੇਡਾਂ ਖੇਡਣ ਦੇ ਬਹੁਤ ਹੀ ਫਾਇਦੇ ਹਨ ਅਸੀਂ ਆਪਣੇ ਪਿੰਡਾਂ ਵਿੱਚ ਕਾਫ਼ੀ ਇਕੱਠੇ ਹੋ ਕੇ ਖੇਡਾਂ ਖੇਡਦੇ ਹਾਂ ਅਸੀਂ ਰੋਜ਼ ਦੀ ਰੁਟੀਨ ਬਣਾਈ ਹੈ ਕਿ ਅਸੀਂ ਖੇਡਾਂ ਖੇਡੀ ਖੇਡੀਆਂ ਹਨ ਖੇਡਾਂ ਖੇਡਣ ਨਾਲ ਇੱਕ ਤਾਂ ਬੰਦਾ ਤੰਦਰੁਸਤ ਰਹਿੰਦਾ ਹੈ ਖੇਡਾਂ ਖੇਡਣ ਨਾਲ ਸਰੀਰ ਦਾ ਮੁੜ੍ਹ ਸਰੀਰ ਵਿੱਚੋਂ ਮੁੜ੍ਹਕਾ ਨਿਕਲਦਾ ਹੈ ਜਿਸ ਨਾਲ ਸਰੀਰ ਦਾ ਰੋਮ ਰੋਮ ਖੁੱਲ੍ਹ ਜਾਂਦਾ ਹੈ ਜਿਸ ਕਰਕੇ ਸਰੀਰ ਦੀਆਂ ਕਈ ਬਿਮਾਰੀਆਂ ਕੱਟੀਆਂ ਜਾਂਦੀਆਂ ਹਨ ਅਤੇ ਸਰੀਰ ਅਤੇ ਦਿਮਾਗ ਹਮੇਸ਼ਾ ਲਈ ਤੰਦਰੁਸਤ ਰਹਿੰਦੇ ਹਨ ਖੇਡਾਂ ਖੇਡਣ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਅਤੇ ਖੇਡਾਂ ਵੱਲ ਜ਼ਿਆਦਾ ਧਿਆਨ ਰਹਿੰਦਾ ਹੈ